ਨੌ ਜੂਨ ਉੱਨੀ ਸੌ ਨੜਿਨਵੇਂ ਗਿਆਰ੍ਹਾਂ ਅਪ੍ਰੈਲ ਉੱਨੀ ਸੌ ਅਠਾਨਵੇਂ ਨੌ ਜੂਨ ਉਨ ਦੋ ਹਜ਼ਾਰ ਇੱਕੀ ਤਿੰਨ ਅਕਤੂਬਰ ਉੱਨੀ ਸੌ ਚੁਹੱਤਰ ਨੌ ਫਰਵਰੀ ਉੱਨੀ ਸੌ ਤੇਹੱਤਰ